ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਪ ਕੌਰ ਗੱਲ ਕਰ ਰਹੀ ਹਾਂ ਮੋਹਾਲੀ ਤੋਂ ਮੈਂ ਪਿਛਲੇ ਹਫ਼ਤੇ ਇੱਕ ਪੀਜ਼ਾ ਔਡਰ ਕੀਤਾ ਸੀ ਚੀਜ਼ ਪੀਜ਼ਾ ਜੋ ਕਿ ਮੈਨੂੰ ਅਤੇ ਮੇਰੇ ਬੇਟੇ ਨੂੰ ਬਹੁਤ ਪਸੰਦ ਆਇਆ ਅਤੇ ਮੈਂ ਅੱਗੇ ਵੀ ਇਹ ਔਡਰ ਕਰਨਾ ਚਾਹੁੰਦੀ ਹਾਂ ਅਤੇ ਉਹਦੀ ਡ ਪੇਮੈਂਟ ਮੈਂ ਡਿਲੀਵਰੀ 'ਤੇ ਕਰ ਦੇਵਾਂਗੀ ਧੰਨਵਾਦ